ਮੈਂ ਬਹੁਤ ਸਾਰੇ ਛੋਟੇ ਕਾਰੋਬਾਰਾਂ ਬਾਰੇ ਜਾਣਦਾ ਹਾਂ ਜਿਵੇਂ ਕਿ ਮੋਬਾਈਲਾਂ ਦੀ ਦੁਕਾਨ ਮੈਡੀਕਲ ਦੀ ਦੁਕਾਨ ਅਤੇ ਕਰਿਆਨਾ ਸਟੋਰ ਅਤੇ ਮੈਨੂੰ ਕੁਝ ਖਾਸ ਜਾਣਕਾਰੀ ਫੋਟੋਗ੍ਰਾਫੀ ਬਾਰੇ ਵੀ ਹੈ ਕਿਉਂਕਿ ਮੇਰਾ ਇੱਕ ਫੋਟੋਗ੍ਰਾਫੀ ਸਟੂਡੀਓ ਹੈ ਅਤੇ ਇਸ ਨੂੰ ਮੈਂ ਪਿਛਲੇ ਚਾਰ ਤੋਂ ਪੰਜ ਸਾਲਾਂ ਤੋਂ ਚਲਾ ਰਿਹਾ ਹਾਂ ਅਤੇ ਇਹ ਸਟੂਡੀਓ ਮੇਰੇ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਕਿਉਂਕਿ ਮੇਰੇ ਦੋਸਤ ਅਤੇ ਮੇਰੇ ਪਿੰਡ ਦੇ ਲੋਕ ਮੇਰੇ ਤੋਂ ਫੋਟੋ ਖਿਚਵਾਉਂਦੇ ਹਨ